ਸਤਿ ਸ਼੍ਰੀ ਅਕਾਲ ਜੀ ਪੰਜਾਬ ਵਿੱਚ ਖੋਜ ਦੇ ਕੇਂਦਰਾਂ ਵਿੱਚ ਜੇ ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਗੱਲ ਕਰੀਏ ਤਾਂ ਇੱਥੇ ਉੱਤਮ ਕਿਸਮ ਦੇ ਬੀਜ ਜੋ ਕਿ ਲੱਭੇ ਜਾਂਦੇ ਹਨ ਤਾਂ ਜੋ ਉਹ ਵੱਧ ਤੋਂ ਵੱਧ ਪੈਦਾਵਾਰ ਹੋ ਸਕੇ ਅਤੇ ਉੱਤਮ ਕਿਸਮ ਦੀ ਪੈਦਾਵਾਰ ਹੋ ਸਕੇ ਏ ਇਹ ਹਰ ਸਾਲ ਹੀ ਇਹਨਾਂ ਯੂਨੀਵਰਸਿਟੀ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਕਈ ਨਵੇਂ ਕਿਸਮ ਦੇ ਬੀਜ ਲੱਭੇ ਗਏ ਹਨ ਜਿਵੇਂ ਚੌਲਾਂ ਦੀਆਂ ਕਈ ਕਿਸਮਾਂ ਲੱਭੀਆਂ ਗਈਆਂ ਹਨ ਹੋਰ ਇਸੇ ਤਰ੍ਹਾਂ ਇਹ ਯੂਨੀਵਰਸਿਟੀ ਜਿਹੜਾ ਇਹ 'ਤੇ ਕੰਮ ਕਰਦੀ ਹੈ ਇਸ ਤੋਂ ਇਲਾਵਾ ਦਵਾਈਆਂ ਦੀ ਖੋਜ ਕੀਤੀ ਜਾਂਦੀ ਹੈ ਸਪਰੇ ਦੀ ਖੋਜ ਕੀਤੀ ਜਾਂਦੀ ਹੈ ਏ ਇਹ ਇਹਨਾਂ ਯੂਨੀਵਰਸਿਟੀਆਂ ਤੋਂ ਰਾਹੀਂ ਹੀ ਸਾਨੂੰ ਨਵੇਂ ਬੀਜ ਮਿਲਦੇ ਹਨ ਸ਼ੁਕਰੀਆ